ਸਤਿ ਸ਼੍ਰੀ ਅਕਾਲ ਮੈਂ ਪ੍ਰਿਆ ਹਾਂਜੀ ਜੀ ਹਾਂ ਸਾਡੇ ਘਰ ਐਲ ਪੀ ਜੀ ਗੈਸ ਕਨੈਕਸ਼ਨ ਹੈਗਾ ਅਤੇ ਅੱਜ ਕੱਲ੍ਹ ਆਮ ਕਰਕੇ ਹਰ ਕਿਸੇ ਇੱਕ ਘਰ ਵਿੱਚ ਐਲ ਪੀ ਜੀ ਗੈਸ ਕਨੈਕਸ਼ਨ ਹੈਗਾ ਮੰਨਦੇ ਹਾਂ ਕਿ ਇਹ ਥੋੜ੍ਹਾ ਮਹਿੰਗਾ ਹੈ ਬਟ ਹਰ ਘਰ ਵਿੱਚ ਇਹ ਉਪਲਬਧ ਹੈ ਅਤੇ ਜੇਕਰ ਗੱਲ ਕੀਤੀ ਜਾਵੇ ਲੱਕੜੀ ਦੀ ਵਰਤੋਂ ਦੀ ਤਾਂ ਪਹਿਲੇ ਲੋਕ ਪਹਿਲੇ ਸਮੇਂ ਵਿੱਚ ਲੱਕੜ ਦੀ ਵਰਤੋਂ ਜ਼ਿਆਦਾ ਕਰਦੇ ਸਨ ਬਟ ਹੁਣ ਇਸ ਦੀ ਵਰਤੋਂ ਬਹੁਤ ਘੱਟ ਗਈ ਹੈ ਕਿਉਂਕਿ ਇਹ ਔਰਤਾਂ ਲਈ ਬਹੁਤ ਹੀ ਕਠਿਨ ਕੰਮ ਹੁੰਦਾ ਸੀ ਕਿ ਲੱਕੜੀਆਂ ਇਕੱਠੀਆਂ ਕਰਕੇ ਲਿਆਉਣਾ ਅਤੇ ਫਿਰ ਉਹਨਾਂ ਨੂੰ ਬਾਲਣਾ ਉਹਨਾਂ ਲਈ ਇੱਕ ਬਹੁਤ ਮੁਸ਼ਕਿਲ ਕੰਮ ਹੁੰਦਾ ਸੀ ਧੰਨਵਾਦ